ਮੈਂ ਦੱਸਣਾ ਚਾਹੁੰਦੀ ਹਾਂ ਵੀ ਮੈਨੂੰ ਅੱਜ ਇੱਕ ਮਤਲਬ ਮੇਰੇ ਬੈਂਕ ਵੱਲੋਂ ਮੈਸੇਜ ਆਇਆ ਕਿ ਮੈਂ ਆਪਣੇ ਨੰਬਰ ਨੂੰ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਜਿਹੜਾ ਹੈਗਾ ਉਹ ਜੋੜ ਲਵਾਂ ਨਹੀਂ ਤਾਂ ਮੇਰੀ ਜਿਹੜੀ ਸਬਸਿਡੀ ਆ ਉਹ ਬੰਦ ਕਰ ਦਿੱਤੀ ਜਾਵੇਗੀ ਉਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਨੌ ਗਿਆਰ੍ਹਾਂ ਦੋ ਹਜ਼ਾਰ ਚੌਵੀ ਤੋਂ ਲੈ ਕੇ ਵੀਹ ਗਿਆਰ੍ਹਾਂ ਦੋ ਹਜ਼ਾਰ ਚੌਵੀ ਤੱਕ ਤੁਸੀਂ ਆਪਣੇ ਜਿਹੜੇ ਹੈਗੇ ਖਾਤੇ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਲਓ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇਸ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ